ਪੰਜਾਬ ਦੀ ਖੇਤੀਬਾੜੀ ਬਲਦਾਂ ਤੋਂ ਲੈ ਕੇ ਹਲਾਂ ਤੋਂ ਹੁੰਦੀ ਹੋਈ ਅੱਜ ਤੱਕ ਟਰੈਕਟਰਾਂ 'ਤੇ ਹੋਣ ਜਾ ਰਹੀ ਹੈ ਜਦੋਂ ਕਿ ਬੀਜ਼ ਕਿਸੇ ਟਾਈਮ ਹੱਥਾਂ ਨਾਲ ਬੀਜ਼ਿਆ ਜਾਂਦਾ ਸੀ ਅਤੇ ਅੱਜ ਸਰਕਾਰ ਨੇ ਅਤੇ ਤਕਨੋਲੋਜੀ ਨੇ ਵਿਗਿਆਨ ਨੇ ਬਹੁਤ ਤਰ੍ਹਾਂ ਦੇ ਉਪਕਰਨ ਬਣਾ ਦਿੱਤੇ ਹਨ ਜਿਨ੍ਹਾਂ ਨਾਲ ਕਿ ਬਿਜਾਈ ਸਿੱਧੀ ਮਸ਼ੀਨ ਨਾਲ ਕੀਤੀ ਜਾਂਦੀ ਹੈ ਇਸ ਨਾਲ ਲੇਬਰ ਦਾ ਖ਼ਰਚਾ ਵੀ ਬਦਲ ਦ ਘੱਟਦਾ ਹੈ ਕਿਸਾਨ ਹੁਣ ਬਹੁਤ ਹੀ ਵਿਗਿਆਨ ਨਾਲ ਜੁੜ ਚੁੱਕਾ ਹੈ ਉਹ ਪੜ੍ਹਿਆ ਲਿਖਿਆ ਹੋ ਗਿਆ ਹੈ ਅਤੇ ਚੰਗੀ ਕਮਾਈ ਪਹਿਲਾਂ ਨਾਲੋਂ ਕਰ ਰਿਹਾ ਹੈ ਇਸ ਨਾਲ ਉਹ ਦੇਸ਼ ਦੀ ਉੱਨਤਾ ਅਤੇ ਪ੍ਰਫੁੱਲਤਾ ਵਿੱਚ ਵੀ ਵਾਧਾ ਕਰ ਰਿਹਾ ਹੈ ਸਟੈਮ ਇਸ ਦੀ ਬਹੁਤ ਵਧੀਆ ਤਰੀਕੇ ਨਾਲ ਮਦਦ ਕਰ ਰਿਹਾ ਹੈ ਜਿੱਥੇ ਕਿ ਉਹ ਬਹੁਤ ਸਾਰਾ ਧੰਨ ਆਪਣਾ ਲੇਬਰ ਨੂੰ ਦਿੰਦਾ ਸੀ ਉਹ ਹੀ ਧੰਨ ਉਹ ਮਸ਼ੀਨ ਖਰੀਦ ਕੇ ਜੋ ਕਿ ਸਰਕਾਰ ਉਸਨੂੰ ਬੈਂਕ ਦੁਆਰਾ ਸਬਸਿਡੀ ਵੀ ਦਿੰਦੀ ਹੈ ਅਤੇ ਉਹ ਉਸ ਨੂੰ ਆਪਣੀ ਊਰਜਾ ਨੂੰ ਬਚਾ ਕੇ ਮਸ਼ੀਨ ਨਾਲ ਕੰਮ ਕਰ ਰਿਹਾ ਹੈ ਅਤੇ ਦੇਸ਼ ਨੂੰ ਬਹੁਤ ਹੀ ਕਰ ਦੇ ਰਿਹਾ ਹੈ ਜਿਸ ਨੂੰ ਅਸੀਂ ਕਿ ਟੈਕਸ ਕਹਿੰਦੇ ਹਾਂ ਅਤੇ ਟੈਕਸ ਨਾਲ ਦੇਸ਼ ਨੂੰ ਬਹੁਤ ਫਾਇਦਾ ਹੋ ਰਿਹਾ ਹੈ ਅਤੇ ਉਹ ਉਸ ਚੀਜ਼ਾਂ ਫਸਲਾਂ ਨੂੰ ਫਲਾਂ ਨੂੰ ਬਾਹ ਬਾਹਰ ਸਬਜ਼ੀਆਂ ਨੂੰ ਐਕਸਪੋਰਟ ਕਰ ਰਿਹਾ ਅਤੇ ਬਹੁਤ ਸਾਰਾ ਧੰਨ ਆਪਣੇ ਦੇਸ਼ ਵਿੱਚ ਲਿਆ ਰਿਹਾ ਹੈ